ਹੈਲੋ ਆਪਣਾ ਗੁਰਪ੍ਰਤਾਪ ਏਜੰਸੀ ਤੋਂ ਬੋਲਦੇ ਹੋ ਮੈਂ ਯਾਦਵਿੰਦਰ ਗੱਲ ਆਪਣਾ ਕਰਨਾ ਪਿਆ ਮੈਂ ਨਾ ਤੁਹਾਡੀ ਗੱਡੀ ਕਰਨੀ ਸੀ ਵੀਰੇ ਕਿਰਾਏ 'ਤੇ ਅਤੇ ਅਸੀਂ ਸ਼ਿਮਲੇ ਪਰਿਵਾਰ ਦਾ ਪਲੈਨ ਸੀ ਵੀ ਸ਼ਿਮਲੇ ਆਪਣਾ ਜਮ ਜਾਣਾ ਸੀ ਆਪਣਾ ਘੁੰਮਣ ਵਾਸਤੇ ਤਾਂ ਸਾਡੇ ਪਰਿਵਾਰ ਦੇ ਵਿੱਚ ਘੱਟੋ ਘੱਟ ਪੰਦਰ੍ਹਾਂ ਜੀਅ ਨੇ ਜੀ ਪੰਦਰ੍ਹਾਂ ਸੋਲ੍ਹਾਂ ਜੀਅ ਅਤੇ ਦੇਖੋ ਵੀ ਤ ਤੁਹਾਡੇ ਜਿਹੜੇ ਕੋਤ ਆਪਣਾ ਨੋਵਾ 'ਚ ਐਡਜਸਟ ਹੋ ਸਕਦੇ ਆ ਜੇ ਨਹੀਂ ਹੋ ਸਕਦਾ ਵੀ ਸਾਨੂੰ ਦੋ ਤਿੰਨ ਆਪਣਾ ਗੱਡੀਆਂ ਦਾ ਅੱਛਾ ਇੰਤਜ਼ਾਮ ਕੀਤਾ ਜਮੀ ਵੀ ਜਾਵੇ ਅਤੇ ਤਾਂ ਤੁਹਾਡਾ ਮੇਰੇ ਕੋਲ ਨੰਬਰ ਆ ਜਾ ਚੁੱਕਾ ਅਤੇ ਤੁਸੀਂ ਮੈਨੂੰ ਵਟਸਐਪ 'ਤੇ ਜਾਂ ਆਪਣਾ ਫ਼ੋਨ ਕਰਕੇ ਕਹਿ ਸਕਦੇ ਹੋ ਵੀ ਉਹ ਸ਼ਿਮਲੇ ਜਾਣ ਦਾ ਕਿੰਨਾ ਰੈਂਟ ਹੈ ਅਤੇ ਸਾਡੇ ਉੱਥੇ ਲੱਗ ਜਾਣੇ ਨੇ ਜੀ ਆਪਣਾ ਦੋ ਤਿੰਨ ਦਿਨ ਅਤੇ ਠੀਕ ਹੈ ਜੀ ਜੇ ਤੁਹਾਨੂੰ ਆਪਣਾ ਠੀਕ ਹੈ ਤੁਹਾਡੇ ਕੋਲ ਟਾਈਮ ਹੈ ਤਾਂ ਅੱਜ ਸ਼ਾਮ ਨੂੰ ਆਪਾਂ ਮਿਲ ਕੇ ਇਸ ਮੈਨੂੰ ਫੋਨ ਆਪਣਾ ਕਰਿਓ ਅਤੇ ਆਪਾਂ ਫਿਰ ਜੋ ਵੀ ਆਪਣੀ ਗੱਲਬਾਤ ਹੈ ਉਹ ਫਿਰ ਅੱਗੇ ਆਪਾਂ ਜਾਰੀ ਰੱਖਾਂਗੇ ਆਪਣਾ ਧੰਨਵਾਦ ਮੈਂ ਯਾਦਵਿੰਦਰਜੀਤ ਸਿੰਘ